ਹੈਲੋ ਮੈਂ ਸੰਤੋਸ਼ ਕੁਮਾਰੀ ਗੁਰਦਾਸਪੁਰ ਤੋਂ ਬੋਲਦੀ ਪਈ ਹਾਂ ਮੈ ਤੁਹਾਨੂੰ ਜਾਨਵਰਾਂ ਦੇ ਵਧੀਆ ਨਸਲ ਦੇ ਜਿਹੜੇ ਜਾਨਵਾਰ ਆ ਉਹਨਾਂ ਬਾਰੇ ਜਾਣਕਾਰੀ ਦੇ ਰਹੀ ਜਿਹੜੀ ਚੰਗੀ ਨਸਲ ਦੇ ਜਾਨਵਰ ਹੁੰਦੇ ਹਨ ਉਹ ਉਹਨਾਂ ਉਹਨਾਂ ਨੂੰ ਸਿਹਤਮੰਦ ਰੱਖਣ ਲਈ ਅਸੀਂ ਉਹਨਾਂ ਨੂੰ ਵਧੀਆ ਚਾਰਾ ਪਾਉਂਦੇ ਹਾਂ ਉਹਨਾਂ ਨੂੰ ਪਾਣੀ ਪਿਆਉਣਾ ਚਾਰਾ ਪਾਉਣਾ ਉਹਨਾਂ ਨੂੰ ਖੁਰਾਕ ਪਾਉਣੀ ਤਾਂ ਕਿ ਉਹਨਾਂ ਦੀ ਸਿਹਤ ਵਧੀਆ ਰਹਿ ਸਕੇ ਠੀਕ ਆ ਉਹਨਾਂ ਦੀ ਸਿਹਤ ਵਧੀਆ ਰਹੇਗੀ ਤਾਂ ਹੀ ਉਹ ਸਾਨੂੰ ਅੱਗੋਂ ਵਧੀਆ ਪ੍ਰੋਫਿਟ ਦੇ ਸਕਦੇ ਹਨ ਇਸ ਲਈ ਸਾਨੂੰ ਚੰਗੀ ਨਸਲ ਦੇ ਪੰਛੀਆਂ ਜਾਨਵਰਾਂ ਨੂੰ ਅਸੀਂ ਇਸ ਤਰ੍ਹਾਂ ਪਹਿਚਾਣ ਸਕਦੇ ਹਾਂ ਉਹਨਾਂ ਦੀ ਸਿਹਤ ਬਹੁਤ ਵਧੀਆ ਹੁੰਦੀ ਹੈ

ਇਸ ਲਈ ਸਾਨੂੰ ਜਾਨਵਰਾਂ ਨੂੰ ਸਾਫ ਸੁਥਰੀ ਥਾਂ 'ਤੇ ਰੱਖਣਾ ਚਾਹੀਦਾ ਹੈ ਉਹਨਾਂ ਥੱਲੇ ਮੈਟ ਵਿਛਾ ਕੇ ਤਾਂ ਕਿ ਅਸੀਂ ਪਾਣੀ ਨਾਲ ਉਹਨਾਂ ਨੂੰ ਚੰਗੀ ਤਰ੍ਹਾਂ ਪਾਇਪ ਲਗਾ ਕੇ ਨਹਾ ਸਕੀਏ ਟਾਈਮ ਨਾਲ ਪਾਣੀ ਪਿਆ ਸਕੀਏ ਭੋਜਨ ਉਹਨਾਂ ਨੂੰ ਟਾਈਮ ਨਾਲ ਦੋ ਉਹਨਾ ਨੂੰ ਮਤਲਬ ਕਿ ਪੱਠੇ ਟਾਈਮ ਨਾਲ ਪਾਓ ਉਹਨਾਂ ਦੀ ਜਿਹੜੀ ਫੀਡ ਚੋਕਰ ਆ ਉਹਨਾਂ ਨੂੰ ਉਹ ਟਾਈਮ ਨਾਲ ਦਿਓ ਤਾਂ ਕਿ ਉਹਨਾਂ ਦੀ ਸਿਹਤ ਵਧੀਆ ਰਹਿ ਸਕੇ ਅਤੇ ਉਹਨਾਂ 'ਚ ਕੋਈ ਬਿਮਾਰੀਆਂ ਨਾ ਪੈਦਾ ਹੋ ਸਕਣ ਸਮੇਂ ਸਮੇਂ ਦੇ ਨਾਲ ਸਾਨੂੰ ਡਾਕਟਰ ਦੀ ਸਲਾਹ ਵੀ ਲੈਂਦੇ ਲੈਣਾ ਰਹਿਣਾ ਚਾਹੀਦਾ ਵਾ ਕਿ ਸਾਡੇ ਜਾਨਵਰ ਕਿ ਆਪਾਂ ਜੋ ਰੱਖੇ ਹੋਏ ਆ ਉਹਨਾਂ ਦਾ ਟਰੀਟਮੈਂਟ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਉਹ ਵਧੀਆ ਰਹਿਣ ਇਸ ਲਈ ਸਾਨੂੰ ਜਾਨਵਰਾਂ ਨੂੰ ਸਾਫ ਸੁਥਰਾ ਅਤੇ ਵਧੀਆ ਤਰੀਕੇ ਨਾਲ ਰੱਖਣਾ ਚਾਹੀਦਾ ਉਹਨਾਂ ਨੂੰ ਵਧੀਆ ਖੁਰਾਕ ਪਾਉਣੀ ਚਾਹੀਦੀ ਆ ਵਧੀਆ ਤਰੀਕੇ ਨਾਲ ਉਹਨਾਂ ਨੂੰ ਖਵਾਉਣਾ ਪਿਆਉਣਾ ਚਾਹੀਦਾ ਹੈ ਇਸ ਲਈ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗੀ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਸੁਣਨ ਲਈ